ਹਾਂਜੀ ਮੈਂ ਆਪਣੇ ਇੱਕ ਦੋਸਤ ਨੂੰ ਪੇਂਟਿੰਗ ਵਾਲਾ ਕਾਰਡ ਜਿਹੜਾ ਸੀਗਾ ਜੋ ਕਿ ਖੁਦ ਮੈਂ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਵੱਖ ਵੱਖ ਰੰਗਾਂ ਦੇ ਨਾਲ ਉਸ ਕਾਰਡ ਨੂੰ ਪੇਂਟ ਕੀਤਾ ਅਤੇ ਆਪਣੇ ਖਾਸ ਦੋਸਤ ਨੂੰ ਦਿੱਤਾ ਉਹ ਕਾਰਡ ਮੇਰੇ ਦੋਸਤ ਨੇ ਹੀ ਨਹੀਂ ਬਲਕਿ ਉਸਦੀ ਫੈਮਲੀ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਉਹ ਕਾਰਡ ਇੰਨਾਂ ਸੋਹਣਾ ਬਣਿਆ ਸੀਗਾ ਕਿ ਸਾਰਿਆਂ ਨੂੰ ਪਸੰਦ ਆਇਆ ਮੈਂ ਉਸਦੇ ਵਿੱਚ ਅਲੱਗ ਅਲੱਗ ਰੰਗ ਵਰਤੇ ਸੀ ਅਲੱਗ ਅਲੱਗ ਤਰ੍ਹਾਂ ਦੀ ਸ਼ਾਇਰ ਸ਼ੇਅਰ ਲਿਖੇ ਸੀਗੇ ਉਹ ਕਾਰਡ ਬਹੁਤ ਜ਼ਿਆਦਾ ਸੋਹਣਾ ਬਣਿਆ ਅਤੇ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੱਥ ਨਾਲ ਬਣੀਆਂ ਚੀਜ਼ਾਂ ਦਾ ਪ੍ਰਾਥਮਿਕ ਮੁੱਲ ਤਾਂ ਹੁੰਦਾ ਏ ਕਿਉਂਕਿ ਆਪਾਂ ਉਹ ਚੀਜ਼ਾਂ ਹੱਥ ਨਾਲ ਨਹੀਂ ਦਿਲ ਨਾਲ ਬਣਾਉਂਦੇ ਹਾਂ ਜਦੋਂ ਆਪਾਂ ਕੋਈ ਚੀਜ਼ ਕਿਸੇ ਖਾਸ ਲਈ ਬਣਾਉਣ ਲੱਗਦੇ ਹਾਂ ਤਾਂ ਉਸ ਚੀਜ਼ ਦੇ ਵਿੱਚ ਆਪਣਾ ਪਿਆਰ ਵੀ ਜੁੜਿਆ ਹੁੰਦਾ ਹੈ ਆਪਣਾ ਦਿਲ ਵੀ ਜੁੜਿਆ ਹੁੰਦਾ ਹੈ ਇਸ ਕਰਕੇ ਉਸ ਚੀਜ਼ ਵਿਚ ਉਸ ਕਾਰਡ ਵਿੱਚ ਮੇਰੀਆਂ ਬਹੁਤ ਸਾਰੀਆਂ ਭਾਵਨਾਵਾਂ ਸੀਗੀਆਂ ਬਹੁਤ ਕੁਛ ਸੀਗਾ ਅਤੇ ਮੈਂ ਉਹ ਜਿਹੜਾ ਕਾਰਡ ਸੀਗਾ ਉਹ ਮਤਲਬ ਆਪਣੇ ਹੱਥ ਨਾਲ ਨਹੀਂ ਆਪਣੇ ਦਿਲੋਂ ਆਪਣੇ ਪਿਆਰ ਦੇ ਨਾਲ ਬਣਾਇਆ ਸੰਜੋਇਆ ਅਤੇ ਉਸ ਕਾਰਡ ਦੇ ਨਾਲ ਮੇਰਾ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀਗੀਆਂ